ਹੈਲੋ ਜੀ ਤੁਸੀਂ ਸਤ ਨਰਸਰੀ ਤੋਂ ਬੋਲ ਰਹੇ ਹੋ ਸਾਨੂੰ ਨਾ ਵੀ ਕਈ ਤਰ੍ਹਾਂ ਦੇ ਬੂਟੇ ਚਾਹੀਦੇ ਹਨ ਜਿਵੇਂ ਗੇਂਦੇ ਦੇ ਫੁੱਲ ਦੇ ਹੋ ਗਏ ਗੁਲਾਬ ਦੇ ਫੁੱਲ ਦੇ ਹੋ ਗਏ ਠੀਕ ਹੈ ਅਤੇ ਹੋਰ ਇੰਸੂਲਿਨ ਦਾ ਫੁੱਲ ਹੋ ਗਿਆ ਠੀਕ ਹੈ ਅਤੇ ਹੋਰ ਜਾਮਣ ਦੇ ਬੂਟੇ ਹੋ ਗਏ ਅੰਬ ਦੇ ਅੰਬ ਦੇ ਬੂਟੇ ਹੋ ਗਏ ਠੀਕ ਆ ਅਤੇ ਅਮਰੂਦ ਦੇ ਬੂਟੇ ਹੋ ਗਏ ਇਹਨਾਂ ਬਾਰੇ ਸਾਨੂੰ ਤੁਹਾਡੇ ਵਾ ਤੋਂ ਕੀ ਨੋਲੇਜ ਮਿਲ ਸਕਦੀ ਆ ਵੀ ਇਹ ਕਿੰਨੇ ਇਹਨਾਂ ਦੀ ਕੀ ਕਿੰਨੇ ਪ੍ਰਕਾਰ ਦੇ ਹੁੰਦੇ ਹੈਗੇ ਆ ਅਤੇ ਇਹਨਾਂ ਦੀ ਅੱਡ ਅੱਡ ਨਸਲਾਂ ਬਾਰੇ ਅਤੇ ਇਹਨਾਂ ਦੇ ਜਿਹੜਾ ਰੇਟ ਹੈ ਠੀਕ ਆ ਜੇ ਇਹਨਾਂ ਨੂੰ ਜਿਹੜੀ ਸਮੇਂ ਸਮੇਂ 'ਤੇ ਜਿਹੜੇ ਬਿਮਾਰੀਆਂ ਲੱਗਣ ਤੋਂ ਬਚਾਅ ਅਤੇ ਦਵਾਈਆਂ ਬਾਰੇ ਠੀਕ ਹੈ ਇਹਦੇ ਬਾਰੇ ਦੱਸਿਆ ਜਾਵੇਗਾ ਜੀ ਤੁਹਾਡੇ ਤੋਂ ਅੱਛਾ ਜੀ ਅਤੇ ਸਾਨੂੰ ਉਹ ਵੀ ਦੱਸੇ ਦੱਸਿਆ ਜਾਵੇਗਾ ਵੀ ਕਿਵੇ ਤੁਹਾਡੇ ਵੱਲੋਂ ਜਿਹੜੀ ਇਹਨਾਂ ਦੀ ਡਿਲੀਵਰੀ ਆ ਉਹ ਸਾਡੇ ਤੱਕ ਪਹੁੰਚ ਜਿਹੜੀ ਕੀਤੀ ਜਾਵੇਗੀ ਅਤੇ ਓਦੋਂ ਵੀ ਤੁਹਾਡਾ ਕੀ ਚਾਰਜ ਲੱਗਣਗੇ ਅਤੇ ਉਹ ਅੱਛਾ ਜੀ ਅਤੇ ਇਹਨਾਂ ਨੇ ਅੱਛਾ ਜੀ ਅਤੇ ਸਾਨੂੰ ਠੀਕ ਹੈ ਜੀ ਅਤੇ ਨਾਲੇ ਸਾਨੂੰ ਇਹ ਵੀ ਦੱਸਿਆ ਜਾਵੇਗਾ ਵੀ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਦਵਾਈਆਂ ਉਹਨਾਂ 'ਚ ਪਾਇਆ ਜਾ ਸਕਦਾ ਵੀ ਵਧੀਆ ਫ਼ਲ ਪ੍ਰਾਪਤ ਕਰਨ ਲਈ ਕਿਹੜੀ ਕਿਹੜੀ ਦਵਾਈਆਂ ਪਾਈਆਂ ਜਾ ਸਕਦੀਆਂ ਉਹ 'ਚ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ